ਮੈਂ ਪਹਿਲੀ ਵਾਰ ਫਲਿਪਕਾਰਡ ਤੋਂ ਨੈਲ ਪੇਂਟ ਔਡਰ ਕੀਤੀ ਸੀ ਨੇਲ ਪੇਂਟ ਜਿਸ ਤਰ੍ਹਾਂ ਦਾ ਰੰਗ ਮੰਗਵਾਇਆ ਸੀ ਉਸੇ ਤਰ੍ਹਾਂ ਦਾ ਆਇਆ ਜਿਸ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਈ ਹੋਰ ਨੇਲ ਪੇਂਟ ਬਿਲਕੁਲ ਠੀਕ ਹਾਲਤ ਵਿੱਚ ਸੀ ਕੋਈ ਵੀ ਟੁੱਟੀ ਫੁੱਟੀ ਨਹੀਂ ਸੀ ਜਿਹੜਾ ਡਿਲੀਵਰੀ ਵਾਲਾ ਭਾਈ ਸੀ ਉਹਨੇ ਮੈਨੂੰ ਪਹਿਲਾਂ ਫੋਨ ਕੀਤਾ ਕਿ ਤੁਹਾਡਾ ਔਡਰ ਆਇਆ ਹੈ ਅਤੇ ਤੁਸੀਂ ਲੈ ਲਓ ਡਿਲੀਵਰੀ ਵਾਲੇ ਦਾ ਸੁਭਾਅ ਬੜਾ ਸ਼ਾਂਤ ਅਤੇ ਚੰਗਾ ਸੀ ਅਤੇ ਨੇਲ ਪੇਂਟ ਨੂੰ ਵੇਖ ਕੇ ਮੇਰੀ ਬਹੁਤ ਰੂਹ ਖੁਸ਼ ਹੋਈ ਜਦੋਂ ਮੈਂ ਨੇਲ ਪੇਂਟ ਲਗਾਈ ਅਤੇ ਉਹ ਮੈਨੂੰ ਬੜੀ ਪਸੰਦ ਆਈ ਧੰਨਵਾਦ